ਅੱਜ ਕੱਲ੍ਹ ਡਿਜੀਟਲ ਫ ਫੋ ਫੋਟੋ ਖਿੱਚਣਾ ਵੀ ਬਹੁਤ ਜ਼ਿਆਦਾ ਉਪ ਉਪਲਬਧ ਨੇ ਸੋਫਟਵੇਅਰ ਉਪਲਬਧ ਨੇ ਜਿਵੇਂ ਜਿਵੇਂ ਕਿ ਵੀ ਡਿਜੀਟਲ ਫੋਟੋਆਂ ਖਿੱਚਣੀਆਂ ਪਹਿਲਾਂ ਤਾਂ ਦੂਜੇ ਕੈਮਰੇ ਹੁੰਦੇ ਸੀ ਆਪਾਂ ਉਹਨਾਂ ਨੂੰ ਗਰਮ ਕਰਨਾ ਅਤੇ ਉਹਨਾਂ ਨੂੰ ਫੋਕਸ ਬਣਾ ਕੇ ਸੈਲ ਦੀ ਯੂਜ ਹੋਣਾ ਅਤੇ ਹੁਣ ਤਾਂ ਅੱਜ ਕੱਲ੍ਹ ਡਿਜੀਟਲ ਕੈਮਰੇ ਆ ਗਏ ਨੇ ਕੁਝ ਅਸੀਂ ਮੋਬਾਈਲਾਂ ਦੀ ਵਰਤੋਂ ਨਾਲ ਵੀ ਫੋਟੋ ਖਿੱਚ ਲੈਂਦੇ ਆ ਜੋ ਕਿ ਮੋਬਾਈਲ ਦੇ ਵਿੱਚ ਵੀ ਆਪਾਂ ਫੋਕਸ ਬਣਾ ਕੇ ਫੋਟੋਆਂ ਖਿੱਚ ਲੈਂਦੇ ਆ ਫੋਟੋ ਖਿੱਚਣਾ ਇੱਕ ਤਸਵੀਰਾਂ ਨੂੰ ਇੱਕ ਸਾਂਝਾ ਕਰਨ ਵਾਸਤੇ ਵੀ ਅੱਜ ਕੱਲ੍ਹ ਡਿਜੀਟਲ ਪ੍ਰੋਗਰਾਮਿੰਗ ਆ ਗਈ ਹੈ ਜੋ ਕਿ ਆਪਾਂ ਕੁਝ ਕੁਝ ਸੀਟੀ ਦੇ ਵਿੱਚ ਵੀ ਫੋਟੋਆਂ ਕਨਵਰਟ ਕਰ ਲਈ ਦੀਆਂ ਹੈ ਅਤੇ ਕੁਝ ਆਪਣੇ ਪਿੰਨਡਰਾਈਵ ਦੇ ਵਿੱਚ ਵੀ ਆਪਾਂ ਫੋਟੋਆਂ ਰੱਖ ਸਕਦੇ ਹਾਂ ਜੋ ਕਿ ਆਪਾਂ ਡੇ ਬਾਈ ਡੇ ਉਹਦੀ ਸਟਰੈਂਥ ਵਧਾ ਵੀ ਸਕਦੇ ਹਾਂ ਜਿਸ ਦੀਆਂ ਫੋਟੋਆਂ ਦੀ ਸਟੈਂਥ ਕਿੰਨੀ ਕਵਰ ਹੋ ਜਾਂਦੀ ਹੈ ਫੋਟੋ ਖਿੱਚਣ ਵਾਸਤੇ ਅੱਜ ਕੱਲ੍ਹ ਬਹੁਤ ਸੇ ਸੋਫਟਵੇਅਰ ਵੀ ਆ ਗਏ ਹਨ ਉਹ ਤਾਂ ਲਾਗੇ ਇੱਕ ਕੈਮਰਾ ਵੀ ਡਿਜਟਲ ਫੋਕਸ ਵਾਲਾ ਲੱਗ ਜਾਂਦਾ ਹੈ ਕਿ ਉਹ ਅਸੀਂ ਦੂਰ ਤੋਂ ਵੀ ਫੋਟੋ ਪਿੱਕ ਕਰ ਸਕੀਏ ਇੱਕ ਦੂਰਬੀਨ ਟਾਈਪ ਵੀ ਕੈਮਰੇ ਵੀ ਆ ਗਏ ਹਨ ਡਿਜੀਟਲ ਕੈਮਰਾ ਜੋ ਕਿ ਉਪਲਬਧ ਹਨ